ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਪੁਰਾਣੇ ਜ਼ਮਾਨੇ ਨਾਲ਼ੋਂ ਅੱਜ ਦਾ ਜ਼ਮਾਨਾ ਬਹੁਤ ਤਰੱਕੀ ਕਰ ਰਿਹਾ ਪੁਰਾਣੇ ਜ਼ਮਾਨੇ ਵਿੱਚ ਸਾਨੂੰ ਚਿੱਠੀਆਂ ਨੂੰ ਕਿਤਾਬਾਂ ਨੂੰ ਸਾਂਭਣ ਲਈ ਬਹੁਤ ਸਾਰੀ ਜਗ੍ਹਾ ਵੀ ਚਾਹੀਦੀ ਹੁੰਦੀ ਸੀਗੀ ਅਤੇ ਸਾਨੂੰ ਪੇਪਰ ਵੀ ਚਾਹੀਦੇ ਹੁੰਦੇ ਆ ਚਿੱਠੀਆਂ ਲਿਖਣ ਲਈ ਕਿਤਾਬਾਂ ਬਣਾਉਣ ਲਈ ਉਹਦੇ ਲਈ ਸਾਨੂੰ ਦਰਖਤਾਂ ਨੂੰ ਕੱਟਣਾ ਪੈਂਦਾ ਸੀ ਪਰ ਅੱਜ ਦੇ ਜ਼ਮਾਨੇ ਲਈ ਇਹ ਕੰਮ ਸੌਖਾ ਹੋ ਗਿਆ ਹੈ ਕਿਉਂਕਿ ਸਾਡੇ ਕੋਲ ਜਿਹੜੀਆਂ ਹੈ ਈ ਬੁੱਕਸ ਆ ਗਈਆਂ ਨੇ ਈ ਬੁੱਕਸ ਦੇ ਵਿੱਚ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਨੂੰ ਈਜ਼ੀਲੀ ਸਟੋਰ ਕਰਕੇ ਲੰਬੇ ਸਮੇਂ ਲਈ ਰੱਖ ਸਕਦੇ ਹੋ ਅਸੀਂ ਕਿਸੇ ਵੀ ਸਾਨੂੰ ਇਹਦੇ ਲਈ ਸਾਨੂੰ ਕੋਈ ਲਾਈਬ੍ਰੇਰੀ ਜਾਣ ਦੀ ਲੋੜ ਨਹੀਂ ਪੈਂਦੀ ਅਗਰ ਅਸੀਂ ਲਾਈਬ੍ਰੇਰੀ ਜਾਂਦੇ ਵੀ ਹਾਂ ਤਾਂ ਸਾਨੂੰ ਜਿਹੜੀ ਸਾਨੂੰ ਬੁੱਕ ਚਾਹੀਦੀ ਹੈ ਪੜ੍ਹਨ ਲਈ ਸਾਨੂੰ ਉਹ ਪ੍ਰੋਵਾਈਡ ਨਹੀਂ ਹੁੰਦੀ ਹੈਗੀ ਠੀਕ ਹੈ ਇਸ ਤਰ੍ਹਾਂ ਅਸੀਂ ਇਹਦੇ ਨਾਲ਼ ਜਿਹੜੀ ਇਹ ਇਹ ਇਨਫੋਰਮੇਸ਼ਨ ਹੈ ਅਸੀਂ ਆਪਣੇ ਫ਼ੋਨ ਦੇ ਵਿੱਚ ਪੀ ਡੀ ਐੱਫ ਬਣਾ ਕੇ ਲੰਬੇ ਸਮੇਂ ਤੱਕ ਸਟੋਰ ਵੀ ਕਰ ਸਕਦੇ ਹਾਂ ਅਸੀਂ ਕਿਸੇ ਨੂੰ ਸ਼ੇਅਰ ਵੀ ਕਰ ਸਕਦੇ ਹਾਂ ਮਤਲਬ ਕਿ ਸਾਨੂੰ ਇਹਦੇ ਲਈ ਕੋਈ ਐਕਸਟਰਾ ਖ਼ਰਚੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਸੀਂ ਆਪਣੇ ਫ਼ੋਨ ਦੇ ਵਿੱਚ ਇਹਨੂੰ ਸ਼ੇਅ ਸਟੋਰ ਕਰਕੇ ਰੱਖ ਸਕਦੇ ਹਾਂ ਅਸੀਂ ਔਨਲਾਈਨ ਵੀ ਇੰਟਰਨੈੱਟ ਤੋਂ ਖਰੀਦ ਸਕਦੇ ਹਾਂ ਮਤਲਬ ਕਿ ਸਾਨੂੰ ਇਹਨਾਂ ਨੂੰ ਅ ਹ ਇਸਨੂੰ ਕੁਛ ਮਤਲਬ ਕਾਗਜ਼ਾਂ ਨੂੰ ਕੱਟ ਬਣਾਉਣ ਲਈ ਇੱਕ ਰੁੱਖਾਂ ਨੂੰ ਵੀ ਨਹੀਂ ਕੱਟਣਾ ਪਵੇਗਾ ਇਸ ਨਾਲ਼ ਅਸੀਂ ਇਕੋ ਫਰੈਂਡਲੀ ਵੀ ਹੋ ਜਾਵਾਂਗੇ